ਹਾਂ ਮੈਂ ਖੇਤਰੀ ਰਾਜ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਅਯੋਜਿਤ ਕੀਤੇ ਕਿਸੇ ਵੀ ਫੋਟੋਗ੍ਰਾਫੀ ਮੁਕਾਬਲੇ ਵਿੱਚ ਹਿੱਸਾ ਲੈਣਾ ਪਸੰਦ ਕਰੂੰਗਾ ਕਿਉਂਕਿ ਇਸ ਨਾਲ ਮੇਰੇ ਫੋਟੋਗ੍ਰਾਫਰ ਦੀ ਪਰੂਵਮੈਟ ਸ਼ਾਮ ਪਰੂਵ ਹੋਵੇਗੀ ਅਤੇ ਫੋਟੋਗ੍ਰਾਫਰ ਦੇ ਨਾਮ ਨੂੰ ਹੋਰ ਕੁਝ ਵੀ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਮੁਕਾਬਲੇ ਵਿੱਚ ਅਕਸਰ ਹੀ ਹਰੇਕ ਦਾ ਮੁਕਾਬਲਾ ਹੁੰਦਾ ਹੈ ਮੁਕਾਬਲੇ ਵਿੱਚ ਕਈ ਤਰ੍ਹਾਂ ਦੇ ਲੋਕ ਲੋਕਾਂ ਨਾਲ ਮਿਲਦੇ ਹਾਂ ਲੋਕਾਂ ਤੋਂ ਸਾਨੂੰ ਬਹੁਤ ਜ਼ਿਆਦਾ ਸਿੱਖਣ ਨੂੰ ਵੀ ਮਿਲਦਾ ਹੈ ਲੋਕ ਹਮੇਸ਼ਾ ਸਾਨੂੰ ਕੁਝ ਨਾ ਕੁਝ ਸਿਖਾ ਕੇ ਜਾਂਦੇ ਹਨ ਜਦੋਂ ਅਸੀਂ ਫੋਟੋਗ੍ਰਾਫਰ ਲੈਵਲ 'ਤੇ ਅੰਤਰਰਾਸ਼ਟਰੀ ਜਾਵਾਂਗੇ ਤਾਂ ਸਾਨੂੰ ਹੋਰ ਕੁਝ ਜੋ ਸਿੱਖਣ ਨੂੰ ਫੋਟੋਗ੍ਰਾਫੀ ਇੱਕ ਅਜਿਹਾ ਕਿੱਤਾ ਹੈ ਜਿਸ ਨੂੰ ਜਿੰਨਾ ਜ਼ਿਆਦਾ ਨਿਖਾਰਾ ਜਾਵੇ ਉਨ੍ਹਾਂ ਜ਼ਿਆਦਾ ਅੱਛਾ ਹੈ ਫੋਟੋਗ੍ਰਾਫਰੀ ਵਿੱਚ ਅਸੀਂ ਜ਼ਿਆਦਾਤਰ ਫੋਟੋਆਂ ਖਿੱਚਣ ਵਾਲੇ ਨੂੰ ਹੀ ਫੋਕਸ ਹੁੰਦਾ ਹੈ ਫੋਟੋਗ੍ਰਾਫਰੀ ਵਿੱਚ ਹਿੱਸਾ ਲੈਣ ਨਹੀਂ ਅਸੀਂ ਕੋਈ ਫਰਸਟ ਦੀ ਉਮੀਦ ਨਹੀਂ ਰੱਖ ਸਕਦੇ ਕਿਉਂਕਿ ਸਾਨੂੰ ਇੰਨਾ ਬਹੁਤ ਹੈ ਕਿ ਸਾਨੂੰ ਫੋਟੋਗ੍ਰਾਫਰੀ ਵਿੱਚ ਅੰਤਰਰਾਸ਼ਟਰੀ ਪੱਧਰ ਮੁਕਾਬਲੇ 'ਤੇ ਮੌਕਾ ਮਿਲਿਆ ਹੋਵੇ ਫੋਟੋਗ੍ਰਾਫਰੀ ਵਿੱਚ ਹਮੇਸ਼ਾ ਦਿਲ ਅਤੇ ਲਗਨ ਨਾਲ ਕੰਮ ਕੀਤਾ ਜਾਂਦਾ ਹੈ ਫੋਟੋਗ੍ਰਾਫਰੀ ਦੇ ਵਿੱਚ ਅਸੀਂ ਮੁਕਾਬਲੇ ਬਹੁਤ ਜ਼ਿਆਦਾ ਖੇਤਰੀ ਲੈਵਲ 'ਤੇ ਜਿੱਤੇ ਹਨ ਪਰ ਜਦੋਂ ਅਸੀਂ ਅਗਾਂਹ ਵਧਦੇ ਹਾਂ ਅੰਤਰਰਾਸ਼ਟਰੀ ਪੱਧਰ 'ਤੇ ਤਾਂ ਅਸੀਂ ਜਿੱਤ ਹਾਰ ਨਹੀਂ ਮਾਈਨੇ ਕਰਦੇ ਸਾਨੂੰ ਐਕਸਪੀਰੀਐਂਸ ਹੋ ਜਾਂਦਾ ਹੈ ਇਸ ਲਈ ਹਾਂ ਸਾਨੂੰ ਜ਼ਰੂਰ ਅੰਤਰਰਾਸ਼ਟਰੀ ਪੱਧਰ 'ਤੇ ਵੀ ਜਾਣਾ ਚਾਹੀਦਾ ਹੈ